ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੇਰੀ ਗੱਲ ਮੀਸ਼ੋ ਵਾਲਿਆਂ ਨਾਲ਼ ਹੋ ਰਹੀ ਹੈ ਹਾਂਜੀ ਹਾਂਜੀ ਭਾਅ ਜੀ ਮੈਂ ਤੁਹਾਡੇ ਇੱਥੋਂ ਇੱਕ ਡਿਨਰ ਸੈੱਟ ਅਤੇ ਕਰੋਕਰੀ ਸੈੱਟ ਮੰਗਵਾਇਆ ਸੀਗਾ ਮੈਂ ਤਾਂ ਰਿਵਿਊ ਦੇਖ ਕੇ ਮੰਗਵਾਇਆ ਸੀਗਾ ਬਟ ਉਹ ਸਮਾਨ ਨਾ ਬਿਲਕੁਲ ਠੀਕ ਨਹੀਂ ਆਇਆ ਹਾਂਜੀ ਹਾਂਜੀ ਉਹਦੇ ਵਿੱਚ ਨਾ ਮੈਂ ਡਿਨਰ ਸੈੱਟ ਦੇ ਨਾਲ਼ ਇੱਕ ਕਰੋਕਰੀ ਸਮਾਨ ਮੰਗਵਾਇਆ ਸੀ ਅਤੇ ਜਿਹਦੇ ਵਿੱਚ ਕੜਾਹੀ ਸੀਗੀ ਫਰਾਈ ਪੈਨ ਸੀਗਾ ਅਤੇ ਹਾਂਜੀ ਮੈਂ ਕੜਾਹੀ ਦਾ ਕਲਰ ਰੈਡ ਮੰਗਵਾਇਆ ਸੀਗਾ ਅਤੇ ਉਹਨਾਂ ਨੇ ਬਲੈਕ ਭੇਜ ਦਿੱਤਾ ਹਾਂਜੀ ਹਾਂਜੀ ਅਤੇ ਡਿਨਰ ਸੈੱਟ ਦੇ ਵਿੱਚ ਵੀ ਥੋੜ੍ਹੀ ਪ੍ਰੋਬਲਮ ਹੈ ਉਹਦਾ ਕਲਰ ਵੀ ਠੀਕ ਨਹੀਂ ਹੈ ਅਤੇ ਉਹਦੀ ਥੋੜ੍ਹੀ ਨਾ ਇੱਕ ਦੋ ਪਲੇਟਸ 'ਚ ਨਾ ਕਰੈਕ ਹੈ ਹਾਂਜੀ ਹਾਂਜੀ ਹਾਂਜੀ ਮੈਂ ਮੈਨੂੰ ਬਸ ਦਿੱਕਤ ਇਹੀ ਓ ਆਈ ਹੈ ਕਿ ਮੇਰਾ ਸਮਾਨ ਜਿਹੜਾ ਆ ਉਹ ਥੋੜ੍ਹਾ ਟੁੱਟਿਆ ਹੋਇਆ ਅਤੇ ਕਲਰ ਸੇਮ ਨਹੀਂ ਹੈ ਹਾਂਜੀ ਹਾਂਜੀ ਸਰ ਮੇਰਾ ਨਾ ਜਸਲੀਨ ਕੌਰ ਦੇ ਨਾਮ 'ਤੇ ਸੀਗਾ ਔਡਰ ਆਈ ਡੀ ਔਡਰ ਆਈ ਡੀ ਸੀਗੀ ਮੇਰੀ ਪੰਜ ਛੇ ਛੇ ਅੱਠ ਦੋ ਇੱਕ ਤਿੰਨ ਸੱਤ ਹਾਂਜੀ ਹਾਂਜੀ ਪ੍ਰਤਾਪ ਨਗਰ ਦੇ ਵਿੱਚ ਹਾਂਜੀ ਹਾਂਜੀ ਆਹ ਸੇਮ ਸੇਮ ਨੰਬਰ ਹੈ ਸੇਮ ਐਡਰੈੱਸ ਹੈ ਅਤੇ ਮੈਂ ਇਸਨੂੰ ਬਦਲਣਾ ਚਾਹੁੰਦੀ ਹਾਂ ਅਤੇ ਕਿਰਪਾ ਕਰਕੇ ਮੇਰੀ ਗੱਲ ਦੇ ਉੱਤੇ ਗੌਰ ਕੀਤਾ ਜਾਵੇ ਹਾਂਜੀ ਹਾਂਜੀ ਧੰਨਵਾਦ ਭਾਅ ਜੀ